ਪੰਜ ਦਸੰਬਰ ਦੋ ਹਜ਼ਾਰ ਪੰਜ ਅੱਠ ਅਕਤੂਬਰ ਦੋ ਹਜ਼ਾਰ ਇੱਕ ਨੌ ਸਤੰਬਰ ਦੋ ਹਜ਼ਾਰ ਬਾਰਾਂ ਇੱਕ ਅਕਤੂਬਰ ਦੋ ਹਜ਼ਾਰ ਤਿੰਨ ਬਾਰਾਂ ਦਸੰਬਰ ਦੋ ਹਜ਼ਾਰ ਤਿੰਨ